ਹੈਲੋ ਮੈਂ ਮੈਮ ਪ੍ਰਭਦੀਪ ਸਿੰਘ ਬੋਲਣ ਦਿਆਂ ਤੁਸੀਂ ਸੁਨੀਤਾ ਮੈਮ ਬੋਲਦੇ ਹਾਂਜੀ ਮੈਮ ਮੈਂ ਨਾ ਇੱਥੇ ਨਿਊ ਸਟੂਡੈਂਟ ਹੀ ਹਾਂ ਮੈਮ ਅਤੇ ਮੈਂ ਪੁੱਛਣਾ ਚਾਹੁੰਦਾ ਪੀ ਤੁਸੀਂ ਪੜ੍ਹਾਈ ਮੈਮ ਇੱਥੋਂ ਦੀ ਕਿੱਦਾਂ ਦੀ ਅਤੇ ਨਾਲੇ ਮੈਮ ਰਹਿਣ ਵਾਸਤੇ ਪੀ ਜੀ ਠੀਕ ਰਹੂਗਾ ਕਿ ਹੋਟਲ

ਮੈਮ ਮੇਰੇ ਦੋਸਤ ਕੋਲੋਂ ਲਿਆ ਮੈਮ ਤੁਹਾਡੇ ਤੁਹਾਡਾ ਨੰਬਰ ਮੈਮ

ਹਾਂਜੀ ਹਾਂਜੀ ਮੈਂ ਪਲੱਸ ਵੰਨ

ਹਾਂਜੀ

ਠੀਕ ਹੈ ਮੈਮ ਥੈਂਕ ਯੂ